ਹੈਲੋ ਮੈਂ ਜਗਦੀਸ਼ ਕੁਮਾਰੀ ਗੁਰਦਾਸਪੁਰ ਤੋੋਂ ਬੋਲ ਰਹੀ ਹਾਂ ਮੈਂ ਤੁਹਾਨੂੰ ਕਿਸਾਨਾਂ ਦੀ ਖੁਸ਼ ਖੁਦਕੁਸ਼ੀ ਕਰਨ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਉਹ ਖੁਦਕੁਸ਼ੀ ਕਿਉਂ ਕਰਦੇ ਹਨ ਕਿਸਾਨ ਦੀ ਖੁਦਕੁਸ਼ੀ ਕਾਰਨ ਇਹ ਹੈ ਕਿ ਇੱਕ ਪ੍ਰਮੁੱਖ ਕਾਰਨ ਇਹ ਹੈ ਕਿ ਫਸਲ ਦੇ ਪੱਕ ਜਾਣ 'ਤੇ ਮੌਸਮ ਖਰਾਬ ਹੋਣ ਹੋਣਾ ਜਿਸ ਵਿੱਚ ਅੰਨ ਜਿਸ ਵਿੱਚ ਅਹਿਣ ਪੈਣਾ ਅੱਗ ਲੱਗਣਾ ਧੁੱਪ ਕਰਕੇ ਅੱਗ ਵੀ ਲੱਗ ਜਾਂਦੀ ਹੈ ਅੱਗ ਵੀ ਲੱਗ ਜਾਂਦੀ ਹੈ ਸਰਕਾਰ ਕੋਈ ਸਰਕਾਰ ਕੋਈ ਮੁਆਵਜ਼ਾ ਵੀ ਨਹੀਂ ਦਿੰਦੀ ਜਿਸ ਕਾਰਨ ਕਿਸਾਨ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਖੁਦਕੁਸ਼ੀ ਕਰਨ ਤੋਂ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਦਾ ਇੱਕ ਨੰਬ ਇੱਕ ਨੰਬਰ ਵੀ ਸਰਕਾਰ ਨੇ ਜਾਰੀ ਕੀਤਾ ਹੈ ਜੋ ਪੰਦਰਾਂ ਇੱਕਵੰਜਾ ਹੈ ਇਸ ਨੰਬਰ 'ਤੇ ਕਿਸਾਨ ਕੋਈ ਵੀ ਜਾਣਕਾਰੀ ਲੈ ਸਕਦਾ ਹੈ ਕਿਸਾਨ ਦੀ ਖੁਦਕੁਸ਼ੀ ਕਰਨ ਤੋਂ ਬਾਅਦ ਉਸਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਕੁਛ ਕਿਸਾਨ ਜਿਹੜੇ ਹੈ ਜਿਹੜੇ ਹਨ ਉਹ ਬੈਂਕ 'ਚੋਂ ਲੋਨ ਵੀ ਲੈ ਲੈਂਦੇ ਹਨ ਜਿਹੜਾ ਉਹਨਾਂ ਨੂੰ ਕੋਲੋਂ ਚੁਕਾਇਆ ਨਹੀਂ ਜਾਂਦਾ ਅਤੇ ਬਹੁਤ ਹੀ ਔਖਾ ਪਰਿਵਾਰ ਉਹਨਾਂ ਦਾ ਚੁਕਾਉਂਦਾ ਹੈ ਇਸ ਕਰਕੇ ਸਾਨੂੰ ਕਰਜ਼ਾ ਨਹੀਂ ਲੈਣਾ ਚਾਹੀਦਾ